ਪੰਜਾਬ ਵਿੱਚ ਧਰਮਾਂ ਦੇ ਰਾਜ ਦੇ ਇਤਿਹਾਸਿਕ ਵੱਜੋਂ ਸੱਭਿਆਚਾਰ ਕਲਾ ਰਵਾਇਤੀ ਅਤੇ ਲੋਕ ਜੀਵਨ ਦੇ ਬਹੁਤ ਵੱਡਾ ਅਸਰ ਪਾਇਆ ਹੈ ਹਰੇਕ ਧਰਮ ਨੇ ਪੰਜਾਬ ਦੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿਸ਼ਾ ਅਤੇ ਨਵੀਂ ਰਵਾਇਤਾਂ ਨਾਲ ਸੰਵਾਰਿਆ ਹੈ ਮੁੱਖ ਤੌਰ 'ਤੇ ਪੰਜਾਬ ਵਿੱਚ ਜੈਨ ਧਰਮ ਬੁੱਧ ਧਰਮ ਇਸਾਈ ਧਰਮ ਅਤੇ ਹੋ ਹਿੰਦੂ ਧਰਮ ਆਦਿ ਸਿੱਖ ਧਰਮ ਬਾਰੇ ਬਹੁਤ ਹੀ ਇਸਲਾਮ ਧਰਮ ਅਤੇ ਹੋਰ ਕਈ ਧਰਮਾਂ ਜੋ ਕਿ ਪੰਜਾਬ ਦੇ ਵਿੱਚ ਮੁੱਖ ਤੌਰ 'ਤੇ ਹ ਮਿਲਦੇ ਹਨ ਜੇ ਆਪਣੇ ਜੈਨ ਧਰਮ ਦੇ ਜੈਨ ਧਰਮ ਇੱਕ ਅਹਿੰਸਾ ਅਤੇ ਸਧਾਰਨ ਜੀਵਨ ਦੇ ਸਿਧਾਂਤਾਂ ਨੇ ਪੰਜਾਬ ਦੇ ਸੱਭਿਆਚਾਰ ਅਤੇ ਸਮਾਜਿਕ ਜੀਵਨ ਨੂੰ ਮੁੱਲਾਂ ਨੂੰ ਬਹੁਤ ਪਛਾਣ ਬਣਾਈ ਹੈ ਜੈਨ ਮੰਦਰਾਂ ਅਤੇ ਧਰਮ ਦੇ ਤਿਉਹਾਰਾਂ ਨੇ ਸਥਾਨਕ ਰਵਾਇਤਾਂ ਨੂੰ ਅਮਰ ਕੀਤਾ ਹੋਇਆ ਹੈ ਬੁੱਧ ਧਰਮ ਪ੍ਰਾਚੀਨ ਕਾਲ ਦੇ ਵਿੱਚ ਬੁੱਧ ਧਰਮ ਨੇ ਵੀ ਪੰਜਾਬ ਵਿੱਚ ਕਾਫੀ ਆਪਣੀ ਪਛਾਣ ਬਣਾਈ ਹੈ ਬੁੱਧ ਮੂਰਤੀ ਕਲਾ ਮਾਨਵਤਾਵਾਦੀ ਸਿਧਾਂਤਾਂ ਦੇ ਅਨੁਸਾਰ ਪੰਜਾਬ ਦੇ ਰੂਹਾਨੀ ਜੀਵਨ ਵਿੱਚ ਇੱਕ ਨਵੀਂ ਰੌਸ਼ਨੀ ਪੈਦਾ ਕਰਦਾ ਹੈ ਇਹਨਾਂ ਧਰਮਾਂ ਦੇ ਨਾਲ ਨਾਲ ਸਿੱਖ ਧਰਮ ਦਾ ਬਹੁਤ ਹੀ ਜ਼ਿਆਦਾ ਯੋਗਦਾਨ ਹੈ ਇਹ ਧਰਮ ਲਗਭਗ ਪੰਦਰਵੀਂ ਸਦੀ ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਦੀ ਸਥਾਪਨਾ ਹੋਣ 'ਤੇ ਇਹ ਹੋਂਦ ਵਿੱਚ ਆਇਆ ਇਸ ਧਰਮ ਦੇ ਵਿੱਚ ਕਈ ਸਿੱਖ ਗੁਰੂ ਪੈਦਾ ਹੋਏ ਜਿਸ ਨੇ ਆਪਣੇ ਸਮੇਂ ਸਮੇਂ ਅਨੁਸਾਰ ਆਪਣੇ ਧਰਮ ਦੇ ਜੀਵਨ ਨੂੰ ਬਣਾਉਣ ਲਈ ਬਹੁਤ ਯੋਗਦਾਨ ਪਾਇਆ ਗੁਰਦੁਆਰਿਆਂ ਦੇ ਵਿੱਚ ਮਹੱਤਵ ਲੰਗਰ ਪ੍ਰਥਾ ਸਿੱਖ ਸਿਧਾਂਤਾਂ ਦੇ ਲੋਕ ਵਿੱਚ ਸਮਾਨਤਾ ਭਾਈਚਾਰਕ ਸਾਂਝ ਪੈਦਾ ਕੀਤੀ ਇਹਨਾਂ ਧਰਮਾਂ ਦੀ ਬਦੌਲਤ ਸਾਰੇ ਲੋਕ ਆਪਸ ਵਿੱਚ ਮਿਲ ਜੁਲ ਕੇ ਊਚ ਨੀਚ ਜਾਤ ਪਾਤ ਤੋਂ ਉੱਪਰ ਉੱਠ ਕੇ ਇਕੱਠੇ ਰਹਿ ਕੇ ਸੱਭਿਆਚਾਰਿਕ ਅਤੇ ਰਿਵਾਇਤਾਂ ਨੂੰ ਮਜ਼ਬੂਤ ਕਰਦਾ ਹੈ ਇਸਲਾਮ ਧਰਮ ਦੇ ਵਿੱਚ ਮੁਗਲ ਸਾਮਰਾਜ ਦੀ ਸਮੇਂ ਦੌਰਾਨ ਬਹੁਤ ਵਾਧਾ ਹੋਇਆ ਪੰਜਾਬ ਦੇ ਕਈ ਹਿੱਸਿਆਂ ਵਿੱਚ ਦਰਗਾਹਾਂ ਅਤੇ ਮਸਜਿਦਾਂ ਦੀ ਵੀ ਸਥਾਪਨਾ ਹੋਈ ਸੂਫੀ ਸੰਤਾਂ ਦੇ ਅਨੁਸਾਰ ਕਵਿਤਾਵਾਂ ਸੰਗੀਤ ਰਾਹੀ ਇਸਲਾਮ ਦੇ ਸੁਨੇਹੇ ਨੂੰ ਦੂਰ ਦੂਰ ਤੱਕ ਫੈਲਾਇਆ ਇਸ ਨਾਲ ਪੰਜਾਬ ਦੇ ਰੂਹਾਨੀ ਤਰਜ ਅਤੇ ਸਮਾਨਤਾ ਦੇ ਸਿਧਾਂਤਾਂ ਨੇ ਪੰਜਾਬੀ ਲੋਕ ਸੱਭਿਆਚਾਰ 'ਤੇ ਗਹਿਰਾ ਅਸਰ ਛੱਡਿਆ ਹੈ ਇਸ ਨਾਲ ਸਮਾਜਿਕ ਜੀਵਨ ਵਿੱਚ ਬਹੁਤ ਵਿਕਾਸ ਹੋਇਆ ਹੈ ਧੰਨਵਾਦ